ਪੰਜਾਬੀ ਗਾਇਕੀ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ ਪੰਜਾਬੀ ਗਾਇਕੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਔਰਤਾਂ ਨੇ ਪੰਜਾਬੀ ਗਾਇਕੀ ਵਿੱਚ ਹਮੇਸ਼ਾ ਹੀ ਆਪਣਾ ਯੋਗਦਾਨ ਦਿੱਤਾ ਹੈ ਚਾਹੇ ਸੂਫੀ ਗੀਤ ਹੋਣ ਚਾਹੇ ਸਭਿਆਚਾਰਕ ਗੀਤ ਹੋਣ ਚਾਹੇ ਪੰਜਾਬੀ ਲੋਕ ਗੀਤ ਹੋਣ ਔਰਤਾਂ ਨੇ ਹਮੇਸ਼ਾ ਹੀ ਇਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਅੱਜ ਕੱਲ੍ਹ ਬਾਣੀ ਸੰਧੂ ਕੌਰ ਬੀ ਮਿਸ ਪੂਜਾ ਸੁਨੰਦਾ ਸ਼ਰਮਾ ਸ਼ਿਪਰਾ ਗੋਇਲ ਆਦਿ ਗਾਇਕਾਵਾਂ ਮਸ਼ਹੂਰ ਹਨ ਜੇ ਮੈਂ ਆਪਣੀ ਮਨ ਪਸੰਦੀਦਾ ਗਾਇਕਾ ਦਾ ਨਾਂ ਦੱਸਾਂ ਤਾਂ ਮੈਨੂੰ ਸ਼ਿਪਰਾ ਗੋਇਲ ਪਸੰਦ ਹੈ ਅਤੇ ਉਸ ਦਾ ਇੱਕ ਗਾਣਾ ਚੂੜੀ ਮੈਨੂੰ ਬਹੁਤ ਜਿਆਦਾ ਪਸੰਦ ਹੈ